ਖੇਤੀਬਾੜੀ ਉਤਪਾਦਾਂ ਨੂੰ ਮੰਡੀਆਂ ਵਿੱਚ ਪਹੁੰਚਾਉਣ ਵਾਸਤੇ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਖੇਤ ਵਿੱਚੋਂ ਕੱਢ ਕੇ ਕੁਛ ਰਸਤੇ ਇਸ ਤਰ੍ਹਾਂ ਦੇ ਹਨ ਕੱਚੇ ਹੁੰਦੇ ਹਨ ਅਤੇ ਉੱਥੇ ਮੁਸ਼ਕਿਲ ਹੁੰ ਆਉਂਦੀ ਹੈ ਅਤੇ ਫਿਰ ਮੰਡੀਆਂ ਦੇ ਵਿੱਚ ਪਹੁੰਚ ਕੇ ਮੰਡੀਆਂ ਦੇ ਵਿੱਚ ਆੜ੍ਹਤੀ ਆਪਣੀ ਮਰਜ਼ੀ ਦਾ ਰੇਟ ਲਗਾਉਂਦੇ ਹਨ ਕਿਸੇ ਨੂੰ ਵੱਧ ਅਤੇ ਕਿਸੇ ਨੂੰ ਘੱਟ ਇਸ ਲਈ ਕਿਸੇ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਅਤੇ ਕਿਸੇ ਨੂੰ ਘਾਟਾ ਵੀ ਪੈ ਜਾਂਦਾ ਹੈ